ਮੇਰਾ ਨਾਮ ਸਤਨਾਮ ਸਿੰਘ ਹੈ ਮੇਰਾ ਪਿੰਡ ਬਾਦਲ ਹੈ ਅੱਜ ਮੇਰੇ ਪੱਕੇ ਮਿੱਤਰ ਸਹਿਜ ਦਾ ਜਨਮਦਿਨ ਹੈ ਇਸ ਲਈ ਪਾਰਟੀ ਕਰਨ ਲਈ ਕੁਝ ਮਿਠਾਈਆਂ ਮੈਂ ਆਪ ਜੀ ਦੀ ਦੁਕਾਨ ਤੋਂ ਮੰਗਵਾਈਆਂ ਸੀ ਜਿਨ੍ਹਾਂ ਵਿੱਚ ਰਸਗੁੱਲੇ ਲੱਡੂ ਬਰਫੀ ਗੁਲਾਬ ਜਾਮੁਨ ਆਦਿ ਸੀ ਇਹਨਾਂ ਦੀ ਗੁਣਵੱਤਾ ਬਹੁਤ ਵਧੀਆ ਸੀ ਇਹ ਮਠਿਆਈਆਂ ਮੇਰੇ ਦੋਸਤਾਂ ਨੂੰ ਬਹੁਤ ਪਸੰਦ ਆਈਆਂ ਅਚਾਨਕ ਮੇਰੇ ਮਿੱਤਰ ਸਹਿਜ ਦੇ ਕਰੀਬੀ ਮਿੱਤਰ ਆਉਣ ਕਰਕੇ ਸਾਡੇ ਦੋਸਤਾਂ ਦੀ ਗਿਣਤੀ ਵੱਧ ਗਈ ਜਿਸ ਕਰਕੇ ਮੈਨੂੰ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਲੋੜ ਹੈ ਮੈਨੂੰ ਇੱਕ ਕਿਲੋ ਰਸਗੁੱਲੇ ਇੱਕ ਕਿਲੋ ਲੱਡੂ ਅਤੇ ਇੱਕ ਕਿਲੋ ਬਰਫੀ ਹੋਰ ਚਾਹੀਦੀ ਹੈ ਇਹ ਚੀਜ਼ਾਂ ਮੈਨੂੰ ਜਲਦੀ ਚਾਹੀਦੀਆਂ ਹਨ ਕਿਰਪਾ ਕਰਕੇ ਇਹ ਮੈਨੂੰ ਬਾਦਲ ਮੇਰੇ ਪਿੰਡ ਬਾਦਲ ਪਹੁੰਚਾ ਦਿਓ